ਅੱਜ ਕੱਲ੍ਹ ਬਿਜਲੀ ਦਾ ਸਾਡੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਯ ਯੋਗਦਾਨ ਹੈ ਸਾਡੇ ਉਦਯੋਗ ਲਘੂ ਉਦਯੋਗ ਵਪਾਰ ਅਤੇ ਇੱਥੋਂ ਤੱਕ ਕਿ ਖੇਤੀਬਾੜੀ ਵੀ ਬਿਜਲੀ ਤੋਂ ਬਿਨਾਂ ਸੰਭਵ ਨਹੀਂ ਹੈ ਬਿਜਲੀ ਕੱਟ ਦੌਰਾਨ ਨਿੱਜੀ ਜ਼ਿੰਦਗੀ ਅਤੇ ਵਪਾਰ ਕਾਫ਼ੀ ਪ੍ਰਭਾਵਿਤ ਹੁੰਦੇ ਹਨ ਪਰ ਅੱਜ ਕੱਲ੍ਹ ਆਧੁਨਿਕ ਸਮੇਂ ਵਿੱਚ ਇੰਨਵੇਟਰ ਸੋਲਰ ਸਿਸਟਮ ਜਨਰੇਟਰਾਂ ਰਾਹੀਂ ਬਿਜਲੀ ਦੀ ਪੂਰਤੀ ਕੀਤੀ ਜਾ ਸਕਦੀ ਹੈ ਜਿਹੜੇ ਕਿ ਅੱਜ ਅੱਜ ਕੱਲ੍ਹ ਆਮ ਘਰਾਂ ਵਿੱਚ ਵੀ ਇੰਨਵੇਟਰ ਦੇਖਣ ਨੂੰ ਮਿਲ ਜਾਂਦੇ ਹਨ ਅਤੇ ਇਹ ਬਿਜਲੀ ਦੇ ਕੱਟਾਂ ਦੌਰਾਨ ਬਿਜਲੀ ਦੀ ਪੂਰਤੀ ਕਰ ਸਕਦੇ ਹਨ